ਰਹਿਣ ਦੀਆਂ ਸਥਿਤੀਆਂ ਨੂੰ ਬਿਹਤਰ ਬਣਾਉਣ ਲਈ ਸ਼ਹਿਰਾਂ ਵਿੱਚ ਨ ਨਵੀਂ ਯੋਜਨਾਵਾਂ ਕਾਫੀ ਕੀਤੀਆਂ ਨੇ ਜਿਵੇਂ ਸ਼ਹਿਰ ਵਿੱਚ ਪੀਲੇ ਕਾਰਡ ਵਾਲਿਆਂ ਨੂੰ ਫਰੀ ਇੰਨਾਂ ਅਨਾਜ ਅਨਾਜ ਦਿੰਦੇ ਨੇ ਅਤੇ ਫਰੀ ਇਹਨਾਂ ਨੂੰ ਇਹਨਾਂ ਦਾ ਇਲਾਜ ਹੁੰਦਾ ਹੋਸਪਿਟਲਾਂ ਹੋਸਪਿਟਲਾਂ ਵਿੱਚ ਜਿਵੇਂ ਕਿ ਕੋਈ ਜ਼ਿਆਦਾ ਗਰੀਬ ਹੈ ਅਤੇ ਉਹਦੇ ਲਈ ਵੀ ਹਸਪਤਾਲਾਂ ਵਿੱਚ ਫਰੀ ਇਲਾਜ ਹੈ ਇਸ ਗੌਰਮੈਂਟ ਦੀਆਂ ਬੜੀਆਂ ਵਧੀਆ ਯੋਜਨਾਵਾਂ ਨੇ ਸ਼ਹਿਰਾਂ ਵਿੱਚ ਪ੍ਰਦੂਸ਼ਣ ਘਟਾਉਣ ਲਈ ਵੀ ਇਹਨਾਂ ਨੇ ਜਗ੍ਹਾ ਜਗ੍ਹਾ 'ਤੇ ਪ੍ਰਦੂਸ਼ਣ ਲਈ ਚੈ ਚੈੱਕ ਪੋਸਟ ਚੈੱਕ ਖੁੱਲ੍ਹੇ ਹੋਏ ਨੇ ਛੋਟੇ ਬੱਚਿਆਂ ਨੂੰ ਛੋਟੇ ਬੱਚੇ ਵੀ ਕਈ ਬਹੁਤ ਜ਼ਿਆਦਾ ਮਸ ਮੋਟਰਸਾਈਕਲ ਬ ਬਾਈਕਾਂ ਉਹ ਐਕਟਿਵਾ ਵਗੈਰਾ ਚਲਾਉਂਦੇ ਨੇ ਅਤੇ ਇਹਨਾਂ ਨੇ ਉਹ ਵੀ ਉਹ ਜਗ੍ਹਾ ਜਗ੍ਹਾ 'ਤੇ ਪੁਲਿਸ ਵਾਲੇ ਖੜ੍ਹੇ ਕੀਤੇ ਹੋਏ ਨੇ ਕਿ ਜਿਹੜੇ ਛੋਟੇ ਬੱਚਿਆਂ ਨੂੰ ਇਹ ਨਾ ਰੋਕਣ ਕਿ ਇਹ ਨਾ ਚਲਾਉਣ ਜਗ੍ਹਾ ਜਗ੍ਹਾ 'ਤੇ ਰੈੱਡ ਲਾਈਟਾਂ ਬਹੁਤ ਵਧੀਆ ਨੇ ਇਸ ਕਰਕੇ ਕੋਈ ਆਉਣ ਜਾਣ ਵਾਲੇ ਆਰਾਮ ਨਾਲ ਜਾਂਦੇ ਨੇ ਕਿਸੇ ਤਰ੍ਹਾਂ ਦਾ ਵੀ ਕੋਈ ਪ੍ਰਦੂਸ਼ਣ ਹੋਣ ਨਹੀਂ ਹੁੰਦਾ ਇਹ ਸਰਕਾਰ ਨੇ ਨਵੇਂ ਕਦਮ ਬੜੇ ਵਧੀਆ ਉਠਾਏ ਨੇ ਜਿਹੜੀਆਂ ਯੋਜਨਾਵਾਂ ਬਹੁਤ ਵਧੀਆ ਨੇ ਨਵੀਆਂ ਯੋਜਨਾਵਾਂ ਲੋਕੀ ਇਹਦਾ ਬਹੁਤ ਫਾਇਦਾ ਉਠਾ ਰਹੇ ਨੇ ਇਸ ਕਰਕੇ ਨਵੀਆਂ ਡਿਸਪੈਸਰੀਆਂ ਵਗੈਰਾ ਵੀ ਬਹੁਤ ਵਧੀਆ ਖੋਲ੍ਹੀਆਂ ਹੋਈਆਂ ਨੇ ਅਤੇ ਜਿੱਥੇ ਲੋਕੀ ਜਾਂਦੇ ਨੇ ਅਤੇ ਇਹਦਾ ਆਪਣਾ ਫਰੀ ਇਲਾਜ ਕਰਾਉਂਦੇ ਨੇ ਅਤੇ ਇਹਦਾ ਬਹੁਤ ਵ ਫਾਇਦਾ ਉਠਾ ਰਹੇ ਨੇ ਨ ਨਵੇਂ ਕਦਮ ਬੜੇ ਵਧੀਆ ਨੇ ਧੰਨਵਾਦ